ਵੱਖ ਵੱਖ ਨੌਕਰੀਆਂ ਦੇ ਮੌਕੇ ਵਿੱਚ ਟੈਕਨਾਲਜੀ ਨੇ ਬਹੁਤ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਜਿਵੇਂ ਕਿ ਪਹਿਲਾਂ ਵਿਦ ਬਿਨਾਂ ਟੈਕਨਾਲਜੀ ਬਿਨਾਂ ਕੰਪਿਊਟਰਸ ਤੋਂ ਜਿਹੜੇ ਕੰਮ ਚਲਦਾ ਹੁੰਦਾ ਸੀ ਉਹ ਜਿਆਦਾਤਰ ਮੈਨੂਅਲ ਹੁੰਦਾ ਸੀ ਹੱਥੀਂ ਹੁੰਦਾ ਸੀ ਸੋ ਉਹਦੇ ਲਈ ਆਪਾਂ ਨੂੰ ਜ਼ਿਆਦਾ ਵਰਕਰ ਦੀ ਜਿ ਲੋੜ ਨਹੀਂ ਹੁੰਦੀ ਸੀ ਪਰ ਜਿਵੇਂ ਜਿਵੇਂ ਟੈਕਨਾਲਜੀ ਵੱਧਦੀ ਗਈ ਕੰਪਿਊਟਰ ਯੁੱਗ ਹੋਣ ਲੱਗ ਗਿਆ ਉਸੇ ਤਰ੍ਹਾਂ ਹੀ ਆਪਾਂ ਨੂੰ ਨੌਕਰੀਆਂ ਦੀ ਆਪਾਂ ਨੂੰ ਨਿਯੁਕਤੀਆਂ ਦੀ ਜ਼ਿਆਦਾ ਮਾਤਰਾ ਵਿੱਚ ਲੋੜ ਪੈਣ ਲੱਗ ਗਈ ਸੋ ਜੋ ਟੈਕਨਾਲਜੀ ਹੈ ਇਹ ਕੋਈ ਸ਼ੱਕ ਨਹੀਂ ਹੈ ਕਿ ਨੌਕਰੀਆਂ ਦੇ ਮੌਕੇ ਖੋਲਣ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਯੋਗਦਾਨ ਹੈ ਅੱਜ ਕੱਲ੍ਹ ਬਹੁਤ ਸਾਰੀਆਂ ਤਕਨੀਕੀ ਡਿਗਰੀਆਂ ਨੇ ਜਿਨ੍ਹਾਂ ਦਾ ਵਿਦਿਆਰਥੀਆਂ ਦਾ ਜਿਹੜਾ ਉਹਨਾਂ ਦਾ ਰੁਝਾਨ ਹੈ ਉਹ ਬਹੁਤ ਜ਼ਿਆਦਾ ਵਧ ਰਿਹਾ ਅਤੇ ਵਿਦਿਆਰਥੀ ਅੱਜ ਕੱਲ੍ਹ ਉਹਨਾਂ ਨੂੰ ਜਾਰੀ ਰੱਖਣਾ ਪਸੰਦ ਕਰਦੇ ਨੇ ਜਿਵੇਂ ਕੀ ਆਪਾਂ ਗੱਲ ਕਰੀਏ ਤਾਂ ਤਕਨੀਕੀ ਯੁੱਗ ਦੀ ਜਿਵੇਂ ਕਿ ਬੀਟੈਕ ਹੋ ਗਈਆਂ ਬੀਟੈਕ ਕੰਪਿਊਟਰ ਦੇ ਵਿੱਚ ਕਰਨੀ ਹੈ ਬੈਚਲਰ ਕੰਪਿਊਟਰ ਦੇ ਵਿੱਚ ਕਰਨੀ ਬੀ ਸੀ ਏ ਹੋ ਗਿਆ ਜੀ ਬੈਚਲਰ ਕੰਪਿਊਟਰ ਔਫ ਐਪਲੀਕੇਸ਼ਨ ਤਾਂ ਇਹ ਜਿਹੀਆਂ ਟੈਕਨੀਕਲ ਜੋਬਸ ਟੈਕਨੀਕਲ ਜਿਹੜੀਆਂ ਡਿਗਰੀਆਂ ਨੇ ਉਹ ਬੱਚੇ ਅੱਜ ਕੱਲ੍ਹ ਜਾਰੀ ਰੱਖਣਾ ਪਸੰਦ ਕਰਦੇ ਨੇ ਕਿਉਂਕਿ ਅੱਜ ਕੱਲ੍ਹ ਉਹਨਾਂ ਦਾ ਰੁਝਾਨ ਟੈਕਨੋਲਜੀ ਵੱਲ ਜ਼ਿਆਦਾ ਹੋ ਗਿਆ ਹਰ ਇੱਕ ਵਿਦਿਆਰਥੀ ਨੂੰ ਹੁੰਦਾ ਕਿ ਉਹ ਨਵੀਂ ਤੋਂ ਨਵੀਂ ਟੈਕਨੋਲਜੀ ਨੂੰ ਸਿੱਖੇ ਨਵੀਂ ਤੋਂ ਨਵੀਂ ਕੰਪਿਊਟਰ ਨੂੰ ਚਲਾਉਣ ਦੇ ਵਿੱਚ ਉਹ ਮਦਦਗਾਰ ਸਾਬਿਤ ਹੋਵੇ